ਅੱਜ ਕੱਲ੍ਹ ਲੋਕ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ ਜਿਵੇਂ ਕਿ ਬੈਡਮਿੰਟਨ ਹੋ ਗਿਆ ਕੁਸ਼ਤੀ ਹੋ ਗਈ ਕਬੱਡੀ ਹੋ ਗਈ ਫੁੱਟਬਾਲ ਹੋ ਗਈ ਕ੍ਰਿਕਟ ਇਹ ਖੇਡਾਂ ਜੋ ਕਿ ਸਾਨੂੰ ਲੋਕਾਂ ਵਿੱਚ ਬਹੁਤ ਹੀ ਅੱਜ ਕੱਲ੍ਹ ਪ੍ਰਸਿੱਧ ਹਨ ਅਤੇ ਇਹ ਸਾਨੂੰ ਬਹੁਤ ਹੀ ਸਟ੍ਰੈਸ ਤੋਂ ਦੂਰ ਰੱਖਦੀਆਂ ਹਨ ਕਿਉਂਕਿ ਅੱਜ ਕੱਲ੍ਹ ਦੇ ਜੋ ਲੋਕ ਹਨ ਉਹ ਬਹੁਤ ਹੀ ਬੀਜ਼ੀ ਹੋ ਗਏ ਹਨ ਆਪਣੇ ਕੰਮਾਂ ਕਾਰਾਂ ਵਿੱਚ ਸੋ ਉਸਨੂੰ ਜੋ ਕਿ ਬੰਦੇ ਅੱਜ ਕੱਲ੍ਹ ਸਟ੍ਰੈਸ ਵਿੱਚ ਘਿਰ ਗਏ ਹਨ ਕਿਉਂਕਿ ਉਹਨਾਂ ਕੋਲ ਇਹ ਖੇਡਾਂ ਖੇਡਣ ਲਈ ਟਾਈਮ ਨਹੀਂ ਹੈ ਅਤੇ ਜੋ ਕਿ ਸ਼ਨੀ ਐਤਵਾਰ ਨੂੰ ਬਹੁਤ ਹੀ ਬੰਦੇ ਵਿਹਲੇ ਹੁੰਦੇ ਹਨ ਅਤੇ ਇਹ ਖੇਡਾਂ ਖੇਡ ਕੇ ਆਪਣੇ ਆਪ ਨੂੰ ਤੰਦਰੁਸਤ ਫੀਲ ਕਰਦੇ ਹਨ